ਹੈਲੋ ਹਾਂਜੀ ਕੌਣ ਜੀ ਵਧੀਆ ਵਧੀਆ ਬਾਈ ਤੁਸੀਂ ਹਾਂਜੀ ਬਾਈ ਹਾਂਜੀ ਹਾਂਜੀ ਬਾਈ ਤੋਂ ਮੈਂ ਗੈਰੀ ਗੱਲ ਕਰਦਾ ਠੀਕ ਠੀਕ ਹੈ ਸਰ ਆਪਣੀ ਦ ਦੋ ਟਾਈਮਿੰਗਾਂ ਨੇ ਸਵੇਰ ਦੀ ਤਾਂ ਹੈਗੀ ਆ ਛੇ ਤੋਂ ਦਸ ਹੁੰਦੀ ਆਪਣੀ ਓਪਨ ਜਿੰਮ ਅਤੇ ਸ਼ਾਮ ਨੂੰ ਹੁੰਦੀ ਆ ਬਈ ਚਾਰ ਤੋਂ ਸੱਤ ਤੁਸੀਂ ਦੇਖ ਲਉ ਵੀ ਤੁਹਾਨੂੰ ਇਹ ਸੂਟ ਕਿਹੜੀ ਕਰਦੀ ਆ ਅਤੇ ਆਪਣੇ ਲਵੇ ਸਾਰੇ ਹਾਂ ਹਾਂ ਬਾਈ ਉਹ ਵੀ ਤੁਸੀਂ ਦੇ ਹਾਂ ਹਾਂ ਬਾਈ ਆਪਣੇ ਸਾਰੇ ਡੇ ਨੇ ਅੱਡ ਅੱਡ ਇੱਕ ਨੇ ਲੈਗ ਡੇ ਹੁੰਦਾ ਚੈਸਟ ਡੇ ਸਾਰੇ ਅੱਡ ਅੱਡ ਡੇ ਦੇ ਹਿਸਾਬ ਨਾਲ ਹੁੰਦਾ ਬਾਕੀ ਜਿੰਮ ਦਾ ਸਾਰਾ ਆਪਣੀਆਂ ਨਵੀਆਂ ਮਸ਼ੀਨਾਂ ਹਨ ਕੋਈ ਨਹੀਂ ਬਾਈ ਘਾਬਰੀ ਨਾ ਆਪਾਂ ਨਾਲ ਕਰਾਵਾਂਗੇ ਕੋਈ ਵੀ ਐਕਸਰਸਾਈਜ਼ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਬਾਕੀ ਫੀਸ ਵਗੈਰਾ ਹੈਗੀ ਹੈ ਜੀ ਹਜ਼ਾਰ ਰੁਪਇਆ ਪਰ ਮੰਨਥ ਇੱਕ ਇੱਕ ਹਜ਼ਾਰ ਰੁਪਇਆ ਪਰ ਮੰਨਥ ਹਾਂ ਹਾਂ ਬਾਈ ਫਿਰ ਹੈਗੀ ਆ ਚੌਵੀ ਸੌ ਵਾ ਬਾਈ ਜੇ ਇਕੱਠੇ ਤਿੰਨ ਮਹੀਨਿਆਂ ਦੀ ਭਰਦੇ ਹੋ ਤੁਸੀਂ ਹਾਂ ਹਾਂ ਹਾਂ ਬਾਈ ਨਾ ਕੋਈ ਨਹੀਂ ਆਪਾਂ ਫਿਰ ਆਪਾਂ ਹੋਰ ਵੀ ਲੈਸ ਕਰ ਲਵਾਂਗੇ ਵੀ ਜੇ ਦੋ ਜਣੇ ਹੋਰ ਨੇ ਬਾਕੀ ਤੁਸੀਂ ਡੈਮੋ ਦੇਖ ਸਕਦੇ ਹੋ ਇੱਕ ਦੋ ਦਿਨ ਦਾ ਵੀ ਤੁਹਾਨੂੰ ਜਿੱਦਾਂ ਵੀ ਲੱਗਿਆ ਵੀ ਨਾ ਆਉਣਾ ਜਾਂ ਆਉਣਾ ਫਿਰ ਉਹ ਤੋਂ ਬਾਅਦ ਤੁਹਾਡੀ ਮਰਜ਼ੀ ਆ ਹਾਂ ਹਾਂ ਬਾਈ ਹਾਂ ਹਾਂ ਬਾਈ ਹਾਂ ਹਾਂ ਬਾਈ ਜ ਜਦ ਮਰਜ਼ੀ ਸਟੀਮ ਵਾਲਾ ਬਾਈ ਸਾਰਾ ਕੁਛ ਆ ਆਪਣੇ ਲਈ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ ਜਦ ਮਰਜ਼ੀ ਆਉ ਹਾਂ ਹਾਂ ਓਕੇ ਬਾਈ ਓਕੇ ਓਕੇ ਓ ਥੈਂਕ